ਜਿਸ ਖੇਤਰ ਦੇ ਵਿੱਚ ਮੈਂ ਰਹਿੰਦੀ ਹਾਂ ਮੇਰੇ ਆਲੇ ਦੁਆਲੇ ਕਈ ਤਰ੍ਹਾਂ ਦੇ ਪੰਛੀ ਦੇਖਣ ਨੂੰ ਮਿਲਦੇ ਨੇ ਜਿਨ੍ਹਾਂ ਵਿੱਚੋਂ ਕਾਂ ਕਬੂਤਰ ਤੋਤਾ ਚਿੜੀਆਂ ਮੋਰ ਬਾਜ਼ ਇਹ ਬੜੇ ਕੋਮਨ ਪੰਛੀ ਨੇ ਅਤੇ ਜਿਹੜਾ ਸਾਡਾ ਕੋਲਜ ਦਾ ਗਾਰਡਨ ਆ ਉੱਥੇ ਵੀ ਕਈ ਤਰ੍ਹਾਂ ਦੇ ਪੰਛੀ ਜਿਹੜੇ ਹੈਗੇ ਆ ਅਸੀਂ ਦੇਖਦੇ ਹਾਂ ਰੋਜ਼ ਅਤੇ ਬੜਾ ਚੰਗਾ ਵੀ ਲੱਗਦਾ ਉਹਨੂੰ ਦੇਖ ਕੇ ਅਤੇ ਸਾਡੀ ਜਿਹੜੀ ਕੋਲਜ ਦੀ ਛੱਤ ਹੈ ਉਹਦੇ ਉੱਪਰ ਵੀ ਕਈ ਤਰ੍ਹਾਂ ਦੇ ਕਬੂਤਰ ਜਿਹੜੇ ਹੈਗੇ ਮੈਂ ਦੇਖਦੀ ਹਾਂ ਉੱਥੇ ਅਤੇ ਮੋਸਟਲੀ ਜਿਹੜੇ ਹੈਗੇ ਆ ਉਹ ਅ ਮਤਲਬ ਗ੍ਰੇਅ ਜਿਹੇ ਕਲਰ ਦੇ ਕਬੂਤਰ ਜ਼ਿਆਦਾ ਹੁੰਦੇ ਨੇ ਅਤੇ ਇਹਨਾਂ ਵਿੱਚ ਜਿਹੜੇ ਹੈਗੇ ਨੇ ਮੇਰੇ ਪਸੰਦੀਦਾ ਪੰਛੀ ਹੈਗੇ ਆ ਮੋਰ ਅਤੇ ਬਾਜ਼ ਮੋਰ ਮੇਰਾ ਪਸੰਦੀਦਾ ਪੰਛੀ ਇਸ ਕਰਕੇ ਹੈ ਕਿਉਂਕਿ ਉਹ ਬੜੀ ਅੱਛੀ ਮਤਲਬ ਚੰਗੀ ਪੈਲਾਂ ਪਾਉਂਦਾ ਹੈ ਅਤੇ ਉਹ ਦੇਖਣ ਦੇ ਵਿੱਚ ਵੀ ਬਹੁਤ ਖੂਬਸੂਰਤ ਹੁੰਦਾ ਹੈ ਉਹਦੇ ਜਿਹੜੇ ਪੰਖ ਹੁੰਦੇ ਨੇ ਉਹ ਬੜੇ ਖੂਬਸੂਰਤ ਹੁੰਦੇ ਨੇ ਅਤੇ ਬਾਜ਼ ਮੈਨੂੰ ਇਸ ਲਈ ਪਸੰਦ ਹੈ ਕਿਉਂਕਿ ਇਹ ਬਹੁਤ ਉੱਚੀ ਉਡਾਰੀ ਭਰਦਾ ਅਤੇ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਮਤਲਬ ਸਕਸੈਸ ਹੋਣਾ ਚਾਹੁੰਦੀ ਹਾਂ ਉੱਚਾ ਉੱਡਣਾ ਚਾਹੁੰਦੀ ਹਾਂ ਅਤੇ ਮੈਨੂੰ ਲੱਗਦਾ ਕਿ ਬਾਜ਼ ਜਿਹੜਾ ਹੈਗਾ ਬਹੁਤ ਹੀ ਸਟਰੋਂਗ ਪੰਛੀ ਹੁੰਦਾ ਹੈ ਜਿਹਦੇ ਵਿੱਚ ਲਾਇਕ ਇੰਨੀ ਕੁ ਹਿੰਮਤ ਹੈ ਕਿ ਉਹ ਜਿਹੜਾ ਹੈਗਾ ਦੂਜੇ ਪੰਛੀਆਂ ਤੋਂ ਬਹੁਤ ਹੀ ਉੱਪਰ ਉਡਾਰੀ ਭਰਦਾ ਅਤੇ ਇਵੇਂ ਜ਼ਿੰਦਗੀ ਦੇ ਵਿੱਚ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਜਾ ਕੇ ਵਧਣਾ ਚਾਹੁੰਦੀ ਹਾਂ ਦੂਜਿਆਂ ਦਾ ਬਹੁਤ ਅੱਗੇ ਨਿਕਲਣਾ ਚਾਹੁੰਦੀ ਹਾਂ ਅਤੇ ਮੈਨੂੰ ਲੱਗਦਾ ਕਿ ਇਹ ਹੀ ਮੇਰੇ ਕਾਰਣ ਨੇ ਜਿਸਦੇ ਲਈ ਮੈਨੂੰ ਮੋਰ ਅਤੇ ਬਾਜ਼ ਜਿਹੜੇ ਹੈਗੇ ਬੜੇ ਚੰਗੇ ਲੱਗਦੇ ਨੇ ਅਤੇ ਹੋਰ ਵੀ ਕਈ ਤਰ੍ਹਾਂ ਦੇ ਪੰਛੀ ਰੰਗ ਬਿਰੰਗੇ ਪੰਛੀ ਜਿਹੜੇ ਹੈਗੇ ਨੇ ਅਤੇ ਕਈ ਤਰਾਂ ਦੇ ਪੰਛੀ ਪਰਵਾਸ ਵੀ ਕਰਦੇ ਨੇ ਇੱਥੇ ਜਿਵੇਂ ਕੁਝ ਪੰਛੀ ਨੇ ਜਿਹੜੇ ਕਿ ਇੱਥੇ ਦੇ ਨਹੀਂ ਹੈ ਬਟ ਉਹ ਦੂਜੇ ਜਿਹੜੇ ਹੈਗੇ ਆ ਦੇਸ਼ਾਂ ਤੋਂ ਜਾਂ ਫਿਰ ਦੂਜੇ ਥਾਵਾਂ ਤੋਂ ਸਾਡੇ ਇੱਧਰ ਆਉਂਦੇ ਨੇ ਰਹਿੰਦੇ ਨੇ ਕੁਛ ਟਾਈਮ ਲਈ ਇਹ ਵਾਤਾਵਰਨ ਦੇ ਅਨੁਸਾਰ ਹੁੰਦਾ ਅਤੇ ਬਸ ਇਹ ਹੀ ਜਿਹੜੇ ਹੈਗੇ ਨੇ ਮਤਲਬ ਪੰਛੀ ਜਿਹੜੇ ਮੈਨੂੰ ਪਸੰਦ ਨੇ ਅਤੇ ਕਈ ਹੋਰ ਪੰਛੀ ਨੇ ਜਿਹੜੇ ਇੱਥੇ ਆ ਕੇ ਰਹਿੰਦੇ ਵੀ ਨੇ ਅਤੇ ਸਾਨੂੰ ਦੇਖਣ ਨੂੰ ਵੀ ਮਿਲਦੇ ਨੇ ਇਹ ਵਾਤਾਵਰਨ ਦੇ ਅਨੁਸਾਰ ਬਦਲਦੇ ਰਹਿੰਦੇ ਨੇ